ਨਹੀਂ ਸਾਡੇ ਨੇੜੇ ਸਾਰੇ ਕੋਲ਼ ਕੋਰਸ ਉਪਲਬਧ ਹਨ ਨੇੜੇ ਹੀ ਸਾਡੇ ਯੂਨੀਵਰਸਿਟੀ ਹੈ ਉੱਥੇ ਹਰੇਕ ਤਰ੍ਹਾਂ ਦਾ ਕੋਰਸ ਉਪਲਬਧ ਹੈ ਜਿਸ ਤਰ੍ਹਾਂ ਕਿ ਐੱਮ ਬੀ ਏ ਬੀ ਐੱਡ ਬੀ ਐੱਸ ਸੀ ਐੱਮ ਐੱਸ ਸੀ ਆਦਿ ਸਾਰੇ ਕੋਰਸ ਉਪਲਬਧ ਹਨ ਵਿਦਿਆਰਥੀਆਂ ਨੂੰ ਕਿਤੇ ਹੋਰ ਜਾ ਕੇ ਪੜ੍ਹਾਈ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਪਰ ਥੋੜ੍ਹਾ ਬਾਹਰ ਦਾ ਹੈ ਲੋਕਾਂ ਨੂੰ ਵੀ ਉੱਥੇ ਜ਼ਿਆਦਾ ਵਧੀਆ ਪੜ੍ਹਾਈ ਹੁੰਦੀ ਪਰ ਜੋ ਸਾਡਾ ਮੰਨਣਾ ਹੈ ਉਹ ਇੱਥੇ ਬਿਲਕੁਲ ਆਸਾਨੀ ਨਾਲ਼ ਬੰਦਾ ਪੜ੍ਹਾਈ ਕਰ ਸਕਦਾ ਹੈ ਕਿਉਂਕਿ ਨੇੜੇ ਸਾਡੇ ਵਧੇਰੇ ਕੋਲਜ ਹੈ ਸਰਕਾਰੀ ਅਤੇ ਪ੍ਰਾਈਵੇਟ ਜਿੱਥੇ ਹਰੇਕ ਤਰ੍ਹਾਂ ਦਾ ਕੋਰਸ ਉਪਲਬਧ ਹੈ